ਸਤਿ ਸ੍ਰੀ ਅਕਾਲ ਜੀ ਮੇਰੀ ਗੈਸ ਖਪਤਕਾਰ ਆਈਡੀ ਨੰਬਰ ਅਠਾਹਠ ਛੇ ਸੌ ਪਚਵੰਜਾ ਹੈ ਅਤੇ ਮੇਰਾ ਫ਼ੋਨ ਨੰਬਰ ਅਠਾਨਵੇ ਸੱਤ ਸੌ ਪੰਜੱਤਰ ਉਨਤਾਲੀ ਸੱਤ ਸੌ ਉਨਤਾਲੀ ਹੈ ਮੈਂ ਕਾਫ਼ੀ ਸਮੇਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਸੀ ਜਿਸ ਕਾਰਨ ਮੈਂ ਕੋਈ ਸਿਲੰਡਰ ਬੁੱਕ ਨਹੀਂ ਕੀਤਾ ਹੁਣ ਮੈਂ ਆਪਣੇ ਜੱਦੀ ਸ਼ਹਿਰ ਵਾਪਿਸ ਆ ਚੁੱਕਾ ਹਾਂ ਮੈਂ ਆਪ ਜੀ ਤੋਂ ਜਾਣਕਾਰੀ ਲੈਣਾ ਚਾਹੁੰਦਾ ਹਾਂ ਕਿ ਕੀ ਮੈਨੂੰ ਇਸ ਆਈਡੀ 'ਤੇ ਸਿਲੰਡਰ ਮਿਲ ਸਕਦਾ ਹੈ ਕਿ ਨਹੀਂ ਮੈਨੂੰ ਆਪਣੇ ਪਰਿਵਾਰਿਕ ਘਰ ਲਈ ਇੱਕ ਗੈਸ ਸਿਲੰਡਰ ਬੁੱਕ ਕਰਨ ਦੀ ਜ਼ਰੂਰਤ ਹੈ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਮੈਂ ਆਪਣੀ ਇਸ ਆਈਡੀ 'ਤੇ ਇੱਕ ਗੈਸ ਸਿਲੰਡਰ ਬੁੱਕ ਕਰ ਸਕਦਾ ਹਾਂ ਕਿ ਨਹੀਂ ਜੀ ਤੁਹਾਡਾ ਧੰਨਵਾਦ